ਨਮਸਕਾਰ ਹਾਂਜੀ ਮੈਂ ਬੂਟ ਦੇਖਣੇ ਸੀ ਹਾਂਜੀ ਵਧੀਆ ਜਿਹੇ ਦਿਖਾ ਦਓ ਜੈਂਟਸ ਘਰ ਪਾਉਣ ਨੂੰ ਪੰਜ ਨੰਬਰ ਚਾਰ ਹਜ਼ਾਰ ਵਾਲੀ ਵਾਈਟ ਵਾਲੇ ਦਿਖਾਇਓ ਇਹਦੀ ਸਾਂਭ ਸੰਭਾਲ ਠੀਕ